ਪੰਜਾਬ ਵਿੱਚ ਕਲਾ ਲਈ ਬਹੁਤ ਸਾਰੇ ਸਾਧਨ ਹਨ ਜਿਵੇਂ ਕਿ ਇੱਕ ਫੁੱਲਕਾਰੀ ਹੈ ਪੰਜਾਬੀ ਜੁੱਤੀ ਹੈ ਢੋਲ ਹੈ ਇਹਦੇ ਨਾਲ ਇੱਕ ਤਾਂ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਦਾ ਹੈ ਇਹਦੇ ਨਾਲ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਜੁੜੇ ਹੁੰਦੇ ਹਨ ਜਿਹੜੇ ਗਰੀਬ ਲੋਕ ਹੁੰਦੇ ਹਨ ਜਿਹਨਾਂ ਕੋਲ ਪੈਸਿਆਂ ਦੀ ਕਮੀ ਹੁੰਦੀ ਹੈ ਅਤੇ ਬਹੁਤ ਸਾਰੇ ਐਨਜੀਓ ਇਹੋ ਜਿਹੇ ਜੁੜੇ ਜਾਂਦੇ ਹਨ ਜਿਹੜੇ ਇਹਨਾਂ ਲੋਕਾਂ ਨੂੰ ਇਹ ਕੰਮ ਦਾ ਹੁਨਰ ਸਿਖਾ ਕੇ ਇਹਨਾਂ ਲੋਕਾਂ ਨੂੰ ਪਰ ਪ੍ਰੋਤਸਾਹਿਤ ਕਰਦੇ ਹਨ ਤਾਂ ਕਿ ਉਹ ਅੱਗੇ ਵੱਧ ਕੇ ਇਹ ਕੰਮ ਸਿੱਖਣ ਅਤੇ ਆਪਣੇ ਦੇਸ਼ ਦੀ ਜਾਂ ਪੰਜਾਬ ਦੀ ਕਲਾ ਨੂੰ ਜਿਸ ਇਲਾਕੇ ਦੀ ਜਿਹੜੀ ਕਲਾ ਹੈ ਉਸ ਨੂੰ ਪ੍ਰੋਤਸਾਹਿਤ ਕੀਤਾ ਜਾਣ ਹੁਣ ਬਹੁਤ ਸਾਰੇ ਲੋਕ ਜਿੱਦਾਂ ਫੁਲਕਾਰੀ ਹੈ ਇਹ ਜਨਾਨੀਆਂ ਘਰ ਬਹਿ ਕੇ ਸਿੱਖ ਲੈਂਦੇ ਇੱਕ ਤਾਂ ਉਹਨਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਅਤੇ ਦੂਸਰਾ ਉਹਨਾਂ ਦੇ ਨਾਲ ਉਹਨਾਂ ਨੂੰ ਪੈਸੇ ਮਿਲ ਜਾਂਦੇ ਹਨ ਤੀਸਰਾ ਉਹਨਾਂ ਨੂੰ ਘਰ ਬੈਠੇ ਹੀ ਕੰਮ ਕਰਨਾ ਪੈਂਦਾ ਹਨ ਕਈ ਲੋਕ ਇਹੋ ਜਿਹੇ ਵੀ ਹੁੰਦੇ ਹਨ ਜਿਹਨਾਂ ਕੋਲ ਘਰੋਂ ਹੀ ਉਹਨਾਂ ਦਾ ਸਮਾਨ ਬਣਾਇਆ ਹੋਇਆ ਲੈ ਜਾਂਦੇ ਹਨ ਅਤੇ ਉਹ ਬ ਅੱਗੇ ਜਾ ਕੇ ਵੇਚ ਦਿੰਦੇ ਹਨ ਇਸ ਤਰ੍ਹਾਂ ਦੇ ਨਾਲ ਢੋਲ ਹੈ ਜਾਂ ਬਹੁਤ ਸਾਰੀ ਇਹੋ ਜਿਹੀਆਂ ਚੀਜ਼ਾਂ ਹਨ ਜੋ ਢੋਲ ਜੋ ਪੰਜਾਬ ਦਾ ਬਹੁਤ ਜ਼ਿਆਦਾ ਇੱਕ ਬਹੁਤ ਜ਼ਿਆਦਾ ਸਾਜ ਮੰਨਿਆ ਜਾਂਦਾ ਹੈ ਚੰਗਾ ਜਿਹਨੂੰ ਹਰ ਅਸੀਂ ਵਿਆਹ ਸ਼ਾਦੀਆਂ ਦੇ ਮੌਕਿਆਂ ਦੇ ਉੱਤੇ ਜ਼ਰੂਰ ਵਜਾਉਂਦੇ ਹੀ ਵਜਾਉਂਦੇ ਹਨ ਕਈ ਲੋਕ ਇਹ ਵੀ ਹੁਨਰ ਸਿੱਖ ਲੈਂਦੇ ਹਨ ਅਤੇ ਉਹਦੇ ਨਾਲ ਇੱਕ ਉਹਨਾਂ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣ ਜਾਂਦਾ ਹੈ ਢੋਲ ਵਜਾ ਕੇ ਲੋਕ ਬਹੁਤ ਸਾਰੇ ਲੋਕ ਆਪਣੇ ਵਿਆਹ ਸ਼ਾਦੀਆਂ 'ਤੇ ਢੋਲ ਮੰਗਵਾਉਂਦੇ ਹਨ ਇੱਕ ਬਹੁਤ ਜ਼ਿਆਦਾ ਖੁਸ਼ੀ ਮਨਾਉਣ ਲਈ ਢੋਲ ਤਾਂ ਮੰਗਾਉਂਦੇ ਹੀ ਮੰਗਾਉਂਦੇ ਹਨ ਲੋਹੜੀ ਦੇ ਉੱਤੇ ਇਹੋ ਜਿਹੇ ਕਈ ਇਹੋ ਜਿਹੇ ਖੁਸ਼ੀਆਂ ਦੇ ਮੌਕੇ ਹਨ ਜਿਹਨਾਂ ਵਿੱਚ ਉਹ ਟੋਲ ਵਗੈਰਾ ਨੂੰ ਬਣ ਬਣਾਉਂਦੇ ਹਨ ਅਤੇ ਇਹ ਢੋਲਚੀ ਜਿਹੜੇ ਹੁੰਦੇ ਹਨ ਇਹ ਢੋਲ ਸਿੱਖ ਕੇ ਤਾਂ ਇਹ ਇੱਕ ਉਹਨਾਂ ਦਾ ਕਮਾਈ ਦਾ ਜ਼ਰੀਆ ਵੀ ਬਣ ਜਾਂਦਾ ਹੈ ਇੱਕ ਉਹ ਬਹੁਤ ਸਾਰੇ ਆਪਾਂ ਪੰਜਾਬੀ ਕਲਚਰ ਨੂੰ ਜਿਵੇਂ ਪੰਜਾਬ ਦੀ ਕਲਾ ਨੂੰ ਪ੍ਰੋਤਸਾਹਿਤ ਵੀ ਕਰਦੇ ਹਨ ਅਤੇ ਇਸ ਤਰ੍ਹਾਂ ਹੀ ਪੰਜਾਬ ਦੇ ਜਿਹੜੇ ਲੋਕ ਹੁੰਦੇ ਹਨ ਉਹ ਇਹ ਆਪਣੀਆਂ ਇਹਨਾਂ ਨਾਲ ਇਹਨਾਂ ਦੀ ਕਲਾ ਹੋਰ ਜ਼ਿਆਦਾ ਵਿਕਸਿਤ ਹੋ ਜਾਂਦ